ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਹਾਊਸ ਵਾਸਤੇ ਦੇਖਦਾ ਪਿਆ ਸੀਗਾ ਖਰੀਦਣ ਵਾਸਤੇ ਜਿਵੇਂ ਟੂ ਬੀ ਐੱਚ ਕੇ ਹੋਵੇ ਨਹੀਂ ਫੁੱਲ ਫੈਮਲੀ ਨਾਲ ਰਵਾਂਗੇ ਸਾਰੇ ਜੋਬ ਤੇ ਲੱਗੇ ਹੋਏ ਆਪਦੀ ਆਪਦੀ ਮੈਂ ਟੀਚਰ ਹੈਗਾ ਮੇਰੇ ਜਿਹੜੇ ਵਾਈਫ ਹੈਗੇ ਉਹ ਵੀ ਟੀਚਰ ਹੈਗੇ ਆ ਪਾਪਾ ਮੇਰੇ ਰਿਟਾਇਰਡ ਹੈਗੇ ਆ ਹਨਾ ਵੈਸੇ ਉੱਥੇ ਹਾਊਸ 'ਚ ਐਵੇ ਹੋਵੇ ਕੀ ਉੱਥੇ ਫਸਿਲਿਟੀ ਵਧੀਆ ਹੋਵੇ ਮੋਟਰ ਦੀ ਫਸਿਲਿਟੀ ਕਿਵੇਂ ਹੈਗੀ ਆ

ਪਾਨੀ ਕਿੰਨੇ ਟੈਮ ਆਉਂਦਾ ਪਾਨੀ ਦਾ ਕੋਈ ਟੈਮ ਵੀ ਹੈਗਾ ਅੱਛਾ ਤੇ ਬਿਜਲੀ ਬਿਜਲੀ ਦਾ ਸਪਲਾਈ ਕਿਵੇਂ ਹੈਗਾ ਅੱਛਿਆ ਅੱਛਿਆ

ਤੇ ਲੈਟ ਉਵੇਂ ਡੀਮ ਵਗੈਰਾ ਤਾਂ ਨੀ ਹੁੰਦੀ ਹੋਰ ਕਿੱਤੇ ਪ੍ਰੋਬਲਮ ਤਾਂ ਨੀ ਆਉਂਦੀ ਨਹੀਂ ਪ੍ਰੋਬਲਮ ਕੋਈ ਤੇ ਰੇਲਵੇ ਸਟੇਸ਼ਨ ਬਸ ਸਟੈਂਡ ਨੇੜੇ ਐ

ਹਾਂ ਅੱਛਿਆ ਤੇ ਜਿਹੜਾ ਏਰੀਆ ਹੈਗਾ ਜਿਵੇਂ ਰਾਤ ਨੂੰ ਕਲੋਨੀ 'ਚ ਆਉਂਦਾ ਰਾਤ ਨੂੰ ਬੰਦ ਹੋ ਜਾਂਦਾ ਕੇ ਰਾਤ ਨੂੰ ਉਹ ਖੁੱਲਾ ਰਹਿੰਦਾ ਰਜਿਸਟੀਡ ਹੋ ਜਾਂਦਾ ਨਾ ਰਾਤ ਅੱਛਾ ਅੱਛਾ ਤੇ ਸਿਕਿਊਰਟੀ ਉਮੇ ਡਾਊਨ ਪੇਮੈਂਟ ਕਿੰਨੀ ਦੇਣੀ ਪਊਗੀ ਅੱਛਾ ਠੀਕ ਐ ਤੇ ਉਮਰ ਹੋਰ ਤਾਂ ਕੁਛ ਨੀ ਪੁੱਛਣਾ ਉਵੇਂ ਬਿਲਡਿੰਗ ਹੈਗੀ ਆ ਕੇ ਫਲੈਟ ਵਗੈਰਾ ਹੈਗਾ ਅੱਛਾ ਅੱਛਾ ਤੇ ਮੈਂ ਕਦੋਂ ਦੇਖਨ ਆ ਸਕਦਾ ਫਲੈਟ ਅੱਛਾ ਠੀਕ ਆ ਓਕੇ